ਹੈਲੋ ਕਿਵੇਂ ਹੋ ਨੰਦਨੀ ਮੈਂ ਵਧੀਆ ਅਤੇ ਕੀ ਕਰ ਰਹੀ ਸੀ

ਮੇਰੀ ਸਿਸਟਰ ਨੇ ਮੈਨੂੰ ਅਡਵਾਈਸ ਦਿੱਤੀ ਵੀ ਤੂੰ ਉੱਥੇ ਗੁਰੂ ਨਾਨਕ ਦੇਵ ਯੂਨੀਵਰਸਿਟੀ 'ਚ ਲੱਗ ਜਾ ਅਤੇ ਕੋਈ ਕਹਿ ਰਿਹਾ ਵੀ ਤੂੰ ਖਾਲਸਾ ਕਾਲਜ 'ਚ ਲੱਗ ਜਾ ਅਤੇ ਮੈਂ ਵੀ ਬਹੁਤ ਕਨਫਿਊਜ ਹੋਈ ਪਈ ਹਾਂ ਅੰਮ੍ਰਿਤਸਰ

ਹਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਪਤਾ ਲੱਗਿਆ ਸੀ ਵੀ ਉੱਥੇ ਪਲੇਸਮੈਂਟ ਵਧੀਆ ਦੇ ਦਿੰਦੇ ਆ ਅਤੇ ਇੱਥੇ ਦੇ ਮਤਲਬ ਫੀਸ ਵੀ ਠੀਕ ਹੈ ਤਾਂ ਕਰਕੇ ਮੈਂ ਕਹਿੰਦੀ ਸੀ ਵੀ ਉੱਥੇ ਚੈੱਕ ਕਰ ਲਈਏ ਓਕੇ ਓਕੇ ਨਹੀਂ ਇੱਕ ਵਾਰ ਚੈੱਕ ਤਾਂ ਕਰ ਹਾਂ ਉਹਦੀ ਪਲੇਸਮੈਂਟ ਵਧੀਆ ਗਾ ਮੇਰੀ ਸਿਸਟਰ ਨੇ ਵੀ ਦੱਸਿਆ ਸੀ ਵੀ ਉੱਥੇ ਮਤਲਬ ਆਪਾਂ ਗਰੈਜ਼ੂਏਸ਼ਨ ਕਰਦੇ ਤਾਂ ਉਸ ਤੋਂ ਬਾਅਦ ਨਾਲ ਦੀ ਨਾਲ ਉੱਥੇ ਆਪਾਂ ਨੂੰ ਪਲੇਸਮੈਂਟ ਮਿਲ ਜਾਂਦੀ ਆ ਜੇ ਆਪਣਾ ਵਧੀਆ ਸਕੋਰ ਹੋਏਗਾ ਤਾਂ ਅਤੇ ਆਪਣੇ ਪਰਸੈਂਟੇਜ ਦੇ ਅਕੋਰਡਿੰਗ ਉੱਥੇ ਆਪਾਂ ਹੋਸਟਲ ਵੀ ਲਾ ਸਕਦੇ ਹਾਂ ਪੀਜੀ ਵੀ ਮਿਲ ਸਕਦਾ ਅਤੇ ਵੈਨਸ ਵੀ ਦਿੰਦੇ ਆ ਉਹ ਪ੍ਰੋਵਾਈਡ ਕਰਦੇ ਆ ਤਾਂ ਉਹਦਾ ਖਰਚਾ ਅਲੱਗ ਆ ਜਾਂਦਾ ਹਾਂ ਵੈਨਸ ਹੈਗੀਆਂ ਪਰ ਉਹਦਾ ਖਰਚਾ ਅਲੱਗ ਆਉਂਦਾ ਹਾਂ ਹਾਂ ਹਾਂ ਹਾਂ ਹਾਂ ਮੈਂ ਚੈੱਕ ਤਾਂ ਕਰਨਾ ਹੀ ਹੋਰ ਵੀ ਆਪਣੇ ਕਾਲਜ ਹੈਗੇ ਉਦਾਂ ਤਾਂ ਯੂਨੀਵਰਸਿਟੀਸ ਹੈਗੀਆਂ ਆਪਣੀ ਜਿੱਦਾਂ ਬਠਿੰਡਾ ਦੇ ਵਿੱਚ ਵੀ ਯੂਨੀਵਰਸਿਟੀ ਹੈਗੀ ਆ ਅਤੇ ਸੀ ਯੂ ਟੀ ਵੀ ਹੈਗੀ ਆ ਬਹੁਤ ਯੂਨੀਵਰਸਿਟੀਸ ਆ ਐਗਜ਼ਾਮ ਵੀ ਹੋਣਗੇ ਦਾ ਪੇਪਰ ਵੀ ਹੋਏਗਾ ਪਰ ਇੱਕ ਵਾਰ ਕਨਫਿਊਜ ਆ ਵੀ ਆਪਾਂ ਹੁਣ ਕੀ ਲਈਏ ਬੀ ਟੈਕ ਲਈਏ ਬੀ ਐਸ ਸੀ ਲਈਏ ਜਾਂ ਕੀ ਕਰੀਏ

ਹਾਂ ਨਹੀਂ ਬੀ ਏ ਤਾਂ ਕਰ ਸਕਦੇ ਜੇ ਆਪਾਂ ਇਕੱਲਾ ਮਤਲਬ ਮੈਥ ਲੈ ਲਈਏ ਜਾਂ ਕ ਕਮਿਸਟਰੀ ਦੇ ਵਿੱਚ ਇਕੱਲੀ ਐਮ ਐਸ ਸੀ ਓਪਨ

ਫਿਰ ਆਪਾਂ ਇਕੱਲਾ ਐਡੀਸ਼ਨਲ ਸਬਜੈਕਟ ਲੈਕੇ ਓਨਰਸ ਦੇ ਵਿੱਚ ਵੀ ਤਾਂ ਕਰ ਸਕਦੇ ਆਪਾਂ ਹਾਂ ਕਰ ਸਕਦੇ ਜਿੱਦਾਂ ਆਪਾਂ ਮੈਂ ਇਕੱਲਾ ਮੈਥ ਲਈਏ ਇਕੱਲੀ ਕਮਿਸਟਰੀ ਲੈ ਲਈਏ ਜਾਂ ਇਕੱਲੀ ਆਪਾਂ ਬਾਇਲੋਜੀ ਕਰ ਲਈਏ ਬਾਇਲੋਜੀ ਦੇ ਵਿੱਚ ਆਪਾਂ ਜੂਲੋਜੀ ਲੈ ਲਈ ਹਾਂ ਹਾਂ ਹਾਂ ਹਾਂ ਨਹੀਂ ਇੱਕ ਵਾਰ ਤਾਂ ਚੈੱਕ ਕਰਨੀ ਪਏਗੀ ਨਾ ਇਦਾਂ ਚੈੱਕ ਕਰੇ ਬਿਨਾਂ ਤਾਂ ਕੁਛ ਨਹੀਂ ਮਤਲਬ ਪਤਾ ਲੱਗਣਾ ਕਿਉਂਕਿ ਜਿੰਨਾਂ ਟਾਈਮ ਵਿਜਿਟ ਹੀ ਨਹੀਂ ਕਰਦੇ ਅੱਛਾ ਚੱਲ ਕੋਈ ਗੱਲ ਨਹੀਂ ਆਪਾਂ ਵੇਖ ਲਵਾਂਗੇ ਅਤੇ ਚੱਲ ਤੂੰ ਮੈਨੂੰ ਦੱਸ ਦੀ ਠੀਕ ਹੈ ਹਾਂ ਹਾਂ ਠੀਕ ਹੈ ਠੀਕ ਹੈ ਠੀਕ ਹੈ

ਕੁਛ ਵੀ ਪਾ ਲਵਾਂਗੇ ਹਾਂ ਕੋਈ ਗੱਲ ਨਹੀਂ ਉਹ ਤਾਂ ਵੇਖ ਲਵਾਂਗੇ ਆਪਾਂ ਬਾਅਦ ਵਿੱਚ ਹਾਂ ਓਕੇ ਓਕੇ ਠੀਕ ਠੀਕ ਹੈ ਓਕੇ